ਹਾਂਜੀ ਸਰ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਅੱਛਾ ਠੀਕ ਹੈ ਜੀ ਸਰ ਮੇਰੇ ਮਤਲਬ ਦੁਕਾਨ 'ਤੇ ਹੀ ਮਕੈਨਿਕ ਹੈਗੇ ਨੇ ਉਹ ਵੀ ਦੇਖ ਲੈਣਗੇ ਹਾਂਜੀ ਹਾਂਜੀ ਹਾਂਜੀ ਸਰ ਹਾਂਜੀ ਹਾਂਜੀ ਤੁਸੀਂ ਡਿਟੇਲ 'ਚ ਦੱਸੋ ਸਰ ਮਤਲਬ ਕਿਹੜੀ ਕਿਹੜੀ ਪ੍ਰੋਬਲਮ ਆਪਾਂ ਅੱਛਾ ਉਹ ਵੀ ਇੰਬੈਲਸ ਨੇ

ਅੱਛਾ ਅੱਛਾ ਠੀਕ ਹੈ ਸਰ ਠੀਕ ਹੈ ਸਰ ਅੱਛਾ ਅੱਛਾ ਸਰ ਤੁਸੀਂ ਮਤਲਬ ਇਹ ਤਾਂ ਫਿਰ ਉਹਦੀ ਕੰਡੀਸ਼ਨ ਦੇਖ ਕੇ ਫਿਰ ਤੁਹਾਨੂੰ ਦੱਸਾਂਗੇ ਸਰ ਜੇ ਮਤਲਬ ਕਿ ਕਿੰਨੀ ਕੁ ਕਰੈਕਸ਼ਨ ਕਰਨ ਵਾਲੀ ਫਿਰ ਉਸੇ ਹਿਸਾਬ ਨਾਲ ਦੱਸਣਾ ਪਏਗਾ ਨਾ ਹਾਂਜੀ ਹਾਂਜੀ ਸਰ ਉਹਦੇ ਸਰ ਸਰ ਲੈਦਰ ਵਗੈਰਾ ਦੇਖਣੇ ਪੈਣਗੇ ਨਾ ਸਰ ਹਾਂਜੀ ਸਰ ਸਰ ਤੁਸੀਂ ਮਤਲਬ ਕਦੋਂ ਤੱਕ ਆਪਣੀ ਸ਼ੋਪ 'ਤੇ ਲਿਆ ਦਊਗੇ ਗੱਡੀ ਨੂੰ ਮਤਲਬ ਅੱਛਾ ਸ਼ਾਮ ਨੂੰ ਭੇਜੋਗੋ ਹਾਂਜੀ ਸਰ ਅੱਛਾ ਸਰ ਸਰ ਕੱਲ੍ਹ ਮਤਲਬ ਕੱਲ ਸੁਬਹ ਤੁਸੀਂ ਅਗਰ ਆ ਸਕਦੇ ਤਾਂ ਫਿਰ ਤਾਂ ਜਲਦੀ ਹੋ ਜਾਂਦਾ ਫਿਰ ਸ਼ਾਮ ਤੱਕ ਅਤੇ ਮਤਲਬ ਤੁਸੀਂ ਸ਼ਾਮ ਨੂੰ ਆਓਗੇ ਮਤਲਬ ਕੱਲ ਤੋਂ ਫਿਰ ਤੁਹਾਨੂੰ ਰੋਕਣੀ ਪਏਗੀ ਗੱਡੀ ਫਿਰ ਸੁਬਹਾ ਮਿਲ ਗਿਆ ਅਗਲੇ ਕਿਉਂਕਿ ਕਾਫੀ ਚੀਜ਼ਾਂ ਨੇ ਨਾ ਸਰ ਮਤਲਬ ਤੁਸੀਂ ਸੁਬਹਾ ਜਲਦੀ ਆਓਗੇ ਜਿੱਦਾਂ ਫਿਰ ਤੁਹਾਡਾ ਪਹਿਲਾ ਹੀ ਨੰਬਰ ਲਗਾ ਦਾਂਗੇ ਹਾਂਜੀ ਸਰ ਹਾਂਜੀ ਹਾਂਜੀ ਸਰ ਇਹਦਾ ਮਤਲਬ ਟੋਟਲ ਲਗਭਗ ਮੈਂ ਤੁਹਾਨੂੰ ਆਈਡੀਆ ਨਾਲ ਦੱਸ ਦਿੰਦਾ ਦਸ ਬਾਰ੍ਹਾਂ ਕੁ ਹਜ਼ਾਰ ਖਰਚਾ ਆ ਜਾਏਗਾ ਹਾਂਜੀ ਹਾਂਜੀ ਹਾਂਜੀ ਸਰ ਅਗਰ ਹਾਂਜੀ ਹਾਂਜੀ ਹਾਂਜੀ ਹਾਂਜੀ ਉਹ ਤਾਂ ਸਰ ਸਰ ਅਸੀਂ ਹਾਂਜੀ ਚਲਾ ਕੇ ਵੀ ਦੇਖਾਂਗੇ ਨਾ ਚੈੱਕ ਕਰਾਂਗੇ ਮਤਲਬ ਕੀ ਦਿੱਕਤ ਹੈ ਹਾਂਜੀ ਹਾਂਜੀ ਤੁਸੀਂ ਮਤਲਬ ਜਲਦੀ ਹੋ ਜਿੰਨਾ ਹੋ ਸਕੇ ਜਲਦੀ ਭੇਜਣਾ ਫਿਰ ਬਾਅਦ 'ਚ

ਹਾਂਜੀ ਹਾਂਜੀ ਫਿਰ ਤਾਂ ਵੈਸਟ ਆ ਨਹੀਂ ਤਾਂ ਫਿਰ ਹੋਰ ਕੋਈ ਗੱਡੀ ਆ ਕੇ ਫਿਰ ਸਰ ਤੁਹਾਡਾ ਦਾ ਟਾਈਮ ਲੱਗ ਜਾਏਗਾ ਹਾਂਜੀ ਹਾਂਜੀ ਕੋਈ ਨਾ ਸਰ ਹਾਂਜੀ ਹਾਂਜੀ ਥੋੜ੍ਹੀ ਤਾਂ ਵੇਟ ਕਰ ਲਾਂਗੇ ਸਰ ਕੋਈ ਹਾਂਜੀ ਸਰ ਸਰ ਇਹ ਮਤਲਬ ਹੁਣੇ ਹੀ ਮਤਲਬ ਹੋਈ ਆ ਜਾਂ ਕਾਫੀ ਦਿਨਾਂ ਦਾ ਅੱਛਾ ਅੱਛਾ ਹੈ ਠੀਕ ਹੈ ਸਰ ਹਾਂਜੀ ਹਾਂਜੀ ਠੀਕ ਹੈ ਸਰ ਕੋਈ ਨਹੀਂ ਹਾਂਜੀ ਹਾਂਜੀ